ਸਤਿ ਸ਼੍ਰੀ ਅਕਾਲ ਬਸ ਦੀ ਯਾਤਰਾ ਦਾ ਇੱਕ ਵੱਖਰਾ ਹੀ ਅਨੁਭਵ ਹੁੰਦਾ ਹੈ ਸਵੇਰੇ ਸਵੇਰੇ ਬਸ ਦੇ ਸਫ਼ਰ ਕਰਨਾ ਹੋਵੇ ਤਾਂ ਬਸ ਅੱਡੇ 'ਤੇ ਖੜ੍ਹੇ ਹੋ ਕੇ ਬਸ ਦੀ ਉਡੀਕ ਕਰਨਾ ਆਪਣੇ ਆਪ ਵਿੱਚ ਇੱਕ ਸੋਹਣਾ ਜਿਹਾ ਅਹਿਸਾਸ ਹੁੰਦਾ ਹੈ ਜਦੋਂ ਬੱਸ ਆ ਜਾਂਦੀ ਹੈ ਅਸੀਂ ਆਪਣੀ ਸੀਟ 'ਤੇ ਬੈਠਦੇ ਹਾਂ ਦਿਲ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਹੈ ਬਸ ਚਲ ਪੈਂਦੀ ਹੈ ਅਤੇ ਅਸੀਂ ਆਪਣੀ ਮੰਜ਼ਿਲ ਵੱਲ ਤੁਰ ਪੈਂਦੇ ਹਾਂ ਰਸਤੇ ਵਿੱਚ ਖਿੜਕੀ ਤੋਂ ਬਾਹਰ ਦੇ ਦ੍ਰਿਸ਼ ਵੇਖਣਾ ਹਰਾ ਭਰਾ ਖੇਤ ਨਾ ਪਹਾੜੀਆਂ ਅਤੇ ਸ਼ਹਿਰੀ ਦ੍ਰਿਸ਼ਾਂ ਨੂੰ ਲੰਘਦੇ ਹੋਏ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਬੱਸ ਵਿੱਚ ਹੋਰ ਯਾਤਰੀਆਂ ਨਾਲ ਗੱਲ ਕਰਕੇ ਅਤੇ ਨਵੇਂ ਚਿਹਰੇ ਦੇਖ ਕੇ ਇੱਕ ਨਵੀਂ ਦੁਨੀਆ ਦਾ ਅਨੁਭਵ ਹੁੰਦਾ ਕਦੀ ਕਦੀ ਬੱਸ ਵਿੱਚ ਕਿਸੇ ਨਾਲ ਦੋਸਤੀ ਵੀ ਹੋ ਜਾਂਦੀ ਹੈ ਜੋ ਸਫ਼ਰ ਹੋਰ ਵੀ ਯਾਦਗਾਰ ਬਣਾ ਦਿੰਦੀ ਹੈ ਉਹ ਤੁਹਾਨੂੰ ਮੈਂ ਆਪਣੀ ਬੱਸ ਦੀ ਯਾਤਰਾ ਦਾ ਇੱਕ ਅਨੁਭਵ ਕਰਾਉਂਦੀ ਹਾਂ ਮੇਰਾ ਨਾ ਮੇਰੇ ਨਾਨਕੇ ਪਠਾਨਕੋਟ ਹਨ ਮੈਂ ਪਠਾ ਅੰਮ੍ਰਿਤਸਰ ਦੀ ਹਾਂ ਪਿਛਲੇ ਹਫ਼ਤੇ ਮੈਂ ਪਠਾਨਕੋਟ ਗਈ ਸੀ ਮੈਂ ਬ ਬੱਸ ਵਿੱਚ ਚੜੀ ਸੀ ਬਸ ਨੀਲੇ ਕਲਰ ਦੀ ਸੀ ਬਸ ਸਰਕਾਰੀ ਬੱਸ ਸੀ ਜਦੋਂ ਮੈਂ ਟਿਕਟ ਕਟਵਾਉਣ ਲੱਗੀ ਤਾਂ ਉਹਨਾਂ ਨੇ ਮੈਨੂੰ ਕਿਹਾ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਹੈਗਾ ਮੈਂ ਕਿਹਾ ਹਾਂਜੀ ਹੈਗਾ ਜਦੋਂ ਉਹਨਾਂ ਨੇ ਮੇਰੇ ਟਿਕ ਮੇਰਾ ਆਧਾਰ ਕਾਰਡ ਦੇਖਿਆ ਅਤੇ ਮੇਰੀ ਟਿਕਟ ਕੱਟ ਤੀ ਇੱਕ ਵੱਖਰਾ ਹੀ ਅਨੁਭਵ ਹੋਇਆ ਬੱਸ ਵਿੱਚ ਕਦੇ ਕਦੇ ਇੰਨੇ ਚੰਗੇ ਯਾਤਰੀ ਮਿਲ ਜਾਂਦੇ ਹਨ ਜੋ ਸਾਡੀ ਮਦਦ ਕਰਨ ਲਈ ਬਹੁਤ ਤਤਪਰ ਰਹਿੰਦੇ ਹਨ ਜੋ ਮਦਦ ਕਰ ਦਿੰਦੇ ਹਨ ਉਦੋਂ ਵੀ ਇੱਕ ਬਹੁਤ ਹੀ ਵਧੀਆ ਜਿਹਾ ਅਨੁਭਵ ਹੁੰਦਾ ਹੈ ਬਹੁਤ ਹੀ ਵਧੀਆ ਅਹਿਸਾਸ ਹੁੰਦਾ ਹੈ ਫਿਰ ਇਸ ਦੇ ਵਿੱਚ ਕਦੀ ਕਦੀ ਬੱਸ ਰੁਕਦੀ ਵੀ ਹੈ ਵਿਚ ਬਟਾਲਾ ਸ਼ਹਿਰ ਆਉਂਦਾ ਹੈ ਉਥੇ ਮੈਂ ਉਤਰੀ ਮੈਂ ਖਾਣੇ ਲਈ ਕੁਛ ਲਿਆ ਫਿਰ ਮੈਂ ਖਾਦਾ ਬਹੁਤ ਹੀ ਮਜ਼ਾ ਆਇਆ ਮਜ਼ਾ ਇਕੱਲੀ ਯਾਤ ਮ ਮ ਇਕੱਲੇ ਸੈ ਸਫ਼ਰ ਕਰਨ ਵਿੱਚ ਵੀ ਮਜ਼ਾ ਆ ਜਾਂਦਾ ਹੈ ਕਿਉਂਕਿ ਵੀ ਕਦੀ ਕਦੀ ਵਿਚੇ ਬਹੁਤ ਹੀ ਵਧੀਆ ਇਨਸਾਨ ਮਿਲ ਜਾਂਦੇ ਹਨ ਜੋ ਦੋਸਤੀ ਕਰਵਾ ਕ ਕਰ ਲੈਂਦੇ ਹਨ ਬੱਸ ਦੇ ਸਫ਼ਰ ਦਾ ਇੱਕ ਅਲੱਗ ਹੀ ਅਨੁਭਵ ਹੁੰਦਾ ਹੈ ਧੰਨਵਾਦ